ਸਾਡੇ ਨੇੜੇ ਇੱਕ ਆਰਟ ਐਂਡ ਕਰਾਫਟ ਨਾਮ ਦਾ ਸਟੋਰ ਜ਼ਰੂਰ ਹੈ ਜਿੱਥੇ ਹੱਥ ਦੀਆਂ ਬਣੀਆਂ ਚੀਜ਼ਾਂ ਬਹੁਤ ਸੋਹਣੀਆਂ ਮਿਲ ਜਾਂਦੀਆਂ ਹਨ ਅਤੇ ਨਿਯਮਿਤ ਤੌਰ ਦੇ ਉੱਤੇ ਸਟੇਸ਼ਨਰੀ ਦੇ ਵਿੱਚ ਮੈਂ ਜ਼ਿਆਦਾਤਰ ਕਲੇਅ ਹੋ ਗਈ ਜਾਂ ਫਿਰ ਪੇਂਟਿੰਗ ਦਾ ਥੋੜ੍ਹਾ ਬਹੁਤਾ ਸਮਾਨ ਜਿਵੇਂ ਘਰ ਕਲੇਅ ਦੇ ਨਾਲ ਕੁਝ ਪੋਟਸ ਬਣਾ ਲਏ ਜਾਂ ਦੀਵੇ ਬਣਾ ਲਏ ਉਹਨੂੰ ਪੇਂਟ ਕਰ ਲਿਆ ਇੱਦਾਂ ਦੀ ਸਟੇਸ਼ਨਰੀ ਦਾ ਸਮਾਨ ਆ ਜਿਹੜਾ ਮੈਂ ਉਹ ਲੈਂਦੀ ਹਾਂ ਅਤੇ ਜੇ ਆਪਾਂ ਕਲਾ ਦੀ ਗੱਲ ਕਰੀਏ ਤਾਂ ਮਨਪਸੰਦੀ ਦਾ ਕਲਾ ਵੀ ਮੇਰੀ ਜਿਹੜੀ ਹੈਗੀ ਉਹ ਪੋਟਰੀ ਹੀ ਹੈ ਕਿਉਂਕਿ ਸਾਡੇ ਘਰ ਦੇ ਸਾਹਮਣੇ ਹੀ ਘੁਮਿਆਰ ਰਹਿੰਦੇ ਹਨ ਸੋ ਮੈਂ ਉਹਨਾਂ ਨੂੰ ਬਚਪਨ ਤੋਂ ਹੀ ਦੇਖਿਆ ਹੈ ਕਿ ਕਿਵੇਂ ਕਿਵੇਂ ਉਹ ਘੜੇ ਬਣਾਉਂਦੇ ਹਨ ਕਿਵੇਂ ਉਹ ਸੋਹਣੇ ਸੋਹਣੇ ਪੋਟਸ ਬਣਾਉਂਦੇ ਹਨ ਦਿਵਾਲੀ ਦੇ ਦਿਨਾਂ ਦੇ ਵਿੱਚ ਉਹ ਦੀਵੇ ਬਣਾਉਂਦੇ ਹਨ ਈਵਨ ਮੈਂ ਛੁੱਟੀਆਂ ਦੇ ਵਿੱਚ ਉਹਨਾਂ ਦੇ ਕੋਲ ਜਾ ਕੇ ਉਹ ਹੱਥ ਨਾਲ ਦੀਵੇ ਬਣਾਉਣੇ ਸਿੱਖੇ ਵੀ ਹੈਗੇ ਨੇ ਅਤੇ ਮੈਂ ਅੱਜ ਕੱਲ੍ਹ ਵੀ ਘਰ ਕਲੇਅ ਲਿਆ ਕੇ ਜਾਂ ਲਾਲ ਮਿੱਟੀ ਲਿਆ ਕੇ ਜਿਹੜੀ ਆਪਾਂ ਚੁੱਲ੍ਹਿਆਂ ਦੇ ਉੱਤੇ ਲਾਉਂਦੇ ਹੁੰਦੇ ਸੀਗੇ ਉਹਦੇ ਨਾਲ ਬਹੁਤ ਛੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਉਹ ਘਰ ਬਣਾਉਣ ਦੀ ਟਰਾਈ ਵੀ ਕੀਤੀ ਹੈਗੀ ਅਤੇ ਸਮੱਗਰੀ ਇਹਦੇ ਵਾਸਤੇ ਸਿਰਫ ਸਾਨੂੰ ਇੱਕ ਲਾਲ ਮਿੱਟੀ ਚਾਹੀਦੀ ਹੁੰਦੀ ਹੈ ਅਤੇ ਉਹਨੂੰ ਸਜਾਉਣ ਦੇ ਲਈ ਆਪਾਂ ਪੇਂਟਿੰਗ ਦਾ ਸਮਾਨ ਆ ਜਿਹੜਾ ਉਹ ਸਾਨੂੰ ਚਾਹੀਦਾ ਹੁੰਦਾ ਅਤੇ ਬਹੁਤ ਵਧੀਆ ਕਲਾ ਹੈ ਅਤੇ ਆਪਾਂ ਕਹਿ ਸਕਦੇ ਹਾਂ ਸਸਤੀ ਵੀ ਹੈਗੀ ਆ ਜਿਹਦੇ ਨਾਲ ਆਪਾਂ ਆਪਣੇ ਘਰ ਨੂੰ ਸਜਾਉਣ ਦਾ ਬਹੁਤ ਸਾਰਾ ਸਮਾਨ ਹੈ ਜਿਹੜਾ ਉਹ ਬਣਾ ਸਕਦੇ ਹਾਂ ਬੱਚਿਆਂ ਨੂੰ ਸਿਖਾ ਸਕਦੇ ਹਾਂ ਕਿ ਕਿਵੇਂ ਉਹ ਕਲੇਅ ਦੇ ਨਾਲ ਮਿੱਟੀ ਦੇ ਨਾਲ ਨਵੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਬਣਾ ਸਕਦੇ ਹਨ ਜਿਹਦੇ ਨਾਲ ਬੱਚਿਆਂ ਦੇ ਵਿੱਚ ਵੀ ਆ ਜਿਹੜੀ ਕ੍ਰੀਏਟਿਵਿਟੀ ਆਉਂਦੀ ਹੈ